ਕੁਝ ਸਥਾਨਕ ਸੰਭਾਲ ਜਾਂ ਵਾਤਾਵਰਨ ਸੰਬੰਧੀ ਪਹਿਲਕਦਮੀਆਂ ਕੀ ਹਨ ਜੋ ਤਰਨਤਾਰਨ ਜ਼ਿਲ੍ਹੇ ਵਿੱਚ ਮਹੱਤਵਪੂਰਨ ਹਨ ਜ਼ਿਲ੍ਹੇ ਵਿੱਚ ਸਥਾਨਕ ਸੰਭਾਲ ਜਾਂ ਵਾਤਾਵਰਨ ਦੇ ਸੰਬੰਧ ਵਿੱਚ ਪਹਿਲਾ ਕਦਮ ਇਹ ਹੈ ਕਿ ਸਾਫ਼ ਸੁਥਰਾ ਪਰਿਵੇਸ਼ ਪਹਿਲਾ ਕਦਮ ਇਹ ਹੈ ਕਿ ਸਥਾਨਕ ਸਰਕਾਰ ਅਤੇ ਸਮੁੰਦਰੀ ਪ੍ਰਬੰਧਕ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਾਫ਼ ਸੁਥਰਾ ਅਤੇ ਪਰਿਵੇਸ਼ ਨੂੰ ਸੁਧਾਰਨ ਦੀ ਲੋੜ ਰੱਖਦੇ ਹਨ ਬਿਜਲੀ ਅਤੇ ਪਾਣੀ ਪ੍ਰੋਵਾਈਡ ਕਰਨਾ ਪਾਣੀ ਅਤੇ ਬਿਜਲੀ ਦੀ ਪ੍ਰੋਵਾਈਡ ਲਈ ਇਹ ਜ਼ਰੂਰੀ ਹੈ ਕਿ ਸਥਾਨਕ ਸਰਕਾਰ ਇਹਨਾਂ ਸੁਵਿਧਾਵਾਂ ਨੂੰ ਮਜ਼ਬੂਤ ਕਰੇ ਜ਼ਿਲ੍ਹੇ ਵਿੱਚ ਸਿਖਲਾਈ ਅਤੇ ਸਭ ਸੰਗਤ ਸੁਵਿਧਾਵਾਂ ਦੇ ਵਧੇਰੇ ਦਿਖਾਵਟ ਕਰਨ ਦੀ ਲੋੜ ਹੈ ਜਿਸ ਨਾਲ ਲੋਕ ਹੁਨਰਾਂ ਅਤੇ ਸਿਖਲਾਈ ਵਿੱਚ ਵਧੇਰੇ ਦਿੱਤਾ ਜਾ ਸਕਣਗੇ ਜ਼ਿਲ੍ਹੇ ਵਿੱਚ ਸ਼ਰੇਆਮ ਸਥਾਨਕ ਵਿਕਾਸ ਉਪਾਧੀਆਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਅਤੇ ਤਰੱਕੀ ਦੇ ਮੌਕੇ ਮਿਲ ਸਕਣਗੇ ਸਥਾਨਕ ਸਰਕਾਰ ਨੂੰ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੀ ਮਜ਼ਬੂਤ ਆਧਾਰ ਤਿਆਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਤਰਨਤਾਰਨ ਜ਼ਿਲ੍ਹੇ ਦੀਆਂ ਪਹਿਲਕਦਮੀਆਂ ਸਾਹਮਣੇ ਕੁਝ ਚੁਣੌਤੀਆਂ ਹਨ ਤਰਨਤਾਰਨ ਜ਼ਿਲ੍ਹੇ ਵਿਖੇ ਪਰਿਸਥਿਤੀ ਵਿੱਚ ਤਬਦੀਲੀ ਹੁੰਦੀਆਂ ਹਨ ਜਿਸ ਕਾਰਨ ਕਿਸਾਨ ਅਤੇ ਨੂੰ ਬੁਰਾ ਅਸਰ ਪੈ ਸਕਦਾ ਹੈ ਤਰਨਤਾਰਨ ਜ਼ਿਲ੍ਹੇ ਵਿਖੇ ਦੇ ਨਾਲ ਜ਼ਿਲ੍ਹੇ ਦੇ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਜਿਸ ਨਾਲ ਜ਼ਿਲ੍ਹੇ ਦੀ ਪ੍ਰਦੂਸ਼ਣ ਸੁਧਾਰ ਲਈ ਮਿਹਨਤ ਕਰਨੀ ਪੈਂਦੀ ਹੈ ਸੁਰੱਖ ਤਰਨਤਾਰਨ ਜ਼ਿਲ੍ਹੇ ਦੇ ਕਾਰਨ ਜ਼ਿਲ੍ਹੇ ਵਿੱਚ ਕਾਨੂੰਨੀ ਹੋਰ ਮੁਹਾਰਤ ਅਤੇ ਸੁਰੱਖਿਆ ਨੂੰ ਸੁਧਾਰਨ ਦੀ ਲੋੜ ਹੈ ਜ਼ਿਲ੍ਹੇ ਵਿੱਚ ਨੌਜਵਾਨ ਸਿੱਖਿਆ ਅਤੇ ਦੇ ਵਿਕਾਸ ਨੂੰ ਲੈ ਕੇ ਸਹਿਯੋਗ ਅਤੇ ਪਰਸਪਰ ਸਹਿਯੋਗ ਦੀ ਲੋੜ ਹੁੰਦੀ ਹੈ ਇਹ ਸੱਭ ਚੁਣੌਤੀਆਂ ਅਤੇ ਕਦਮ ਪਹਿਲਾਂ ਦੇ ਆਵਲੋਕਣ ਨੂੰ ਵਾਸਤੇ ਵੱਖਰੇ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੁੰਦੀ ਹੈ ਜਿਹਨਾਂ ਦੀ ਮਦਦ ਨਾਲ ਜ਼ਿਲ੍ਹੇ ਦੀ ਤਰਨਤਾਰਨ ਜ਼ਿਲ੍ਹੇ ਦੀ ਵਧੇਰੇ ਤਰੱਕੀ ਹੋ ਸਕਦੀ ਹੈ ਅਤੇ ਵਾਤਾਵਰਨ ਨੂੰ ਸੁਧਾਰਨ ਲਈ ਸੰਘਰਸ਼ ਕਰ ਸਕਦੇ ਹਾਂ